ਲਾਈਟ ਬੱਲਬ ਬਾਰੇ ਮੇਰਾ ਐਕਸਪੀਰੀਐਂਸ ਇਹ ਹੈ ਅੱਜ ਕੱਲ੍ਹ ਬਜ਼ਾਰ ਦੇ ਵਿੱਚ ਬਹੁਤ ਸਾਰੇ ਇੱਦਾਂ ਦੇ ਪ੍ਰੋਡਕਟ ਲਾਈਟ ਬੱਲਬ ਆ ਚੁੱਕੇ ਨੇ ਅਤੇ ਜਿਹਨਾਂ ਦੇ ਇੰਨੇ ਨੁਕਸਾਨ ਨੇ ਜੋ ਮੇਰੀ ਜ਼ਿੰਦਗੀ ਦੇ ਵਿੱਚ ਖ਼ੁਦ ਵਾਪਰ ਚੁੱਕੇ ਨੇ ਅਤੇ ਇੱਕ ਤਾਂ ਸਭ ਤੋਂ ਵੱਡਾ ਨੁਕਸਾਨ ਇਹ ਹੈ ਕੰਪਨੀ ਦੇ ਜਿਹੜੇ ਪ੍ਰੋਡਕਟ ਨੇ ਦੁਕਾਨਦਾਰ ਬਹੁਤ ਘੱਟ ਵੇਚਦੇ ਨੇੇ ਕਿਉਂਕਿ ਉਹਨਾਂ ਦੇ ਵਿੱਚ ਮਾਰਜਨ ਬਹੁਤ ਘੱਟ ਹੁੰਦਾ ਹੈ ਅਤੇ ਇਹ ਲੋਕ ਬੜੇ ਘਟੀਆ ਕਿਸਮ ਦੇ ਲਾਈਟ ਬੱਲਬ ਵੇਚਦੇ ਨੇ ਜੇ ਜਿਨ੍ਹਾਂ ਦੀ ਇੱਕ ਤਾਂ ਬਿਜਲੀ ਦੀ ਜਿਹੜੀ ਖ਼ਪਤ ਹੈ ਬਹੁਤ ਜ਼ਿਆਦਾ ਹੈ ਅਤੇ ਇੱਕ ਮੰਨ ਲਉ ਸਪੋਜ਼ ਜਿੱਦਾਂ ਕਮਰੇ ਦੇ ਵਿੱਚ ਲਗਾਈਏ ਅਤੇ ਗਰਮਾਹਟ ਬੜੀ ਜਲਦੀ ਪੈਦਾ ਕਰ ਦਿੰਦੇ ਨੇ ਅਤੇ ਇਨ੍ਹਾਂ ਦਾ ਜਿਹੜਾ ਹੈ ਅੱਖਾਂ ਦੇ ਉੱਤੇ ਸਾਡੀ ਜ਼ਿੰਦਗੀ ਦੇ ਜੋ ਅੱਖਾਂ ਨੇ ਬਹੁਤ ਅਹਿਮ ਹਿੱਸਾ ਨੇ ਸਾਡਾ ਅੱਖਾਂ ਦੇ ਉੱਤੇ ਬਹੁਤ ਜਲਦੀ ਅਸਰ ਕਰਦੀਆਂ ਨੇ ਜਿਹੜੀਆਂ ਰੇਂਜ ਵਾਈਬਰੇਸ਼ਨ ਨੇ ਉਹ ਬਹੁਤ ਮਾੜੀਆਂ ਨੇ ਮੈਂ ਇਹ ਸਲਾਹ ਦੇਵਾਂਗਾ ਕਿ ਬਜ਼ਾਰ ਦੇ ਵਿੱਚੋਂ ਵਧੀਆ ਕੰਪਨੀ ਦੇ ਹੀ ਜਿਹੜੇ ਇਹ ਪ੍ਰੋਡਕਟ ਨੇ ਉਹ ਖਰੀਦੇ ਜਾਣ